ਜਿਹੜੀਆਂ ਪਿੰਡਾਂ 'ਚ ਖੇਡਾਂ ਖੇਡੀਆਂ ਜਾਂਦੀਆਂ ਨੇ ਉਹ ਹੋ ਗਿਆ ਗੁੱਲੀ ਡੰਡਾ ਰੱਸੀ ਟੱਪਣਾ ਬਾਂਦਰ ਕਿੱਲਾ ਭੱਜਣ ਭਜਾਈ ਲੁੱਕਣ ਮੀਚੀ ਇਹ ਸਾਰੀਆਂ ਖੇਡਾਂ ਨੇ ਜੋ ਪਿੰਡਾਂ ਦੀਆਂ ਪਿੰਡਾਂ ਦੇ ਬੱਚੇ ਆਪਸ 'ਚ ਰਲ ਮਿਲ ਕੇ ਖੇਡਦੇ ਨੇ ਬਚਪਨ 'ਚ ਖੇਡੀਆਂ ਜਾਂਦੀਆਂ ਨੇ ਅਤੇ ਗੁੱਲੀ ਡੰਡਾ ਹੋ ਗਿਆ ਜਿਵੇਂ ਇਸ ਇਹ ਪਿੰਡਾਂ ਦੀਆਂ ਖੇਡਾਂ ਨੇ ਜਿਨ੍ਹਾਂ ਨਾਲ ਅਸੀਂ ਆਪਣੇ ਆਪ ਨੂੰ ਐਂਟਰਟੇਨ ਵੀ ਕਰਦੇ ਹਾਂ ਕਿ ਦ ਮਨ ਪਰਚਾਵੇ ਦਾ ਵੀ ਸਾਧਨ ਨੇ ਅਤੇ ਜਿਹੜੀਆਂ ਇੱਕ ਸ਼ਹਿਰਾਂ ਦੀਆਂ ਖੇਡਾਂ ਨੇ ਉਹ ਉਹ ਸ਼ਹਿਰਾਂ 'ਚ ਹੋ ਗਿਆ ਚੈੱਸ ਹੋ ਗਿਆ ਬੋਲਿੰਗ ਹੋ ਗਈ ਹੋਰ ਐਦਾਂ ਦੀਆਂ ਖੇਡਾਂ ਨੇ ਜਿਹਦੇ ਨਾਲ ਆਪਾਂ ਨੂੰ ਮਤਲਬ ਆਪਣਾ ਮਨ ਪਰਚਾਵੇ ਦਾ ਵੀ ਸਾਧਨ ਕਹਿ ਸਕਦੇ ਹਾਂ ਪਰ ਉਹਦੇ ਨਾਲ ਇੱਕ ਜਿਹੜਾ ਆਪਸ ਦਾ ਭਾਈਚਾਰਾ ਹੈ ਰਲ ਮਿਲ ਕੇ ਖੇਡਣਾ ਉਹ ਚੀਜ਼ ਨਹੀਂ ਹੈ ਇਹ ਹੈ ਕਿ ਜਿਹੜੀਆਂ ਆਪਾਂ ਪਿੰਡਾਂ 'ਚ ਖੇਡਾਂ ਖੇਡਦੇ ਹਾਂ ਉਹ ਕਾਫੀ ਜਣੇ ਇਕੱਠੇ ਹੋ ਕੇ ਫਿਰ ਖੇਡਦੇ ਹਾਂ ਅਤੇ ਜਿਹੜੀਆਂ ਸ਼ਹਿਰਾਂ ਦੀਆਂ ਖੇਡਾਂ ਉਹ ਚੈੱਸ ਹੋ ਗਈ ਪੋਲਿੰਗ ਹੋ ਗਈ ਉਹ ਬੰਦਾ ਇਕੱਲਾ ਇਕੱਲਾ ਖੇਡਦਾ ਹੈ ਇਸ ਕਰਕੇ ਪਿੰਡਾਂ ਦੀਆਂ ਜਿਹੜੀਆਂ ਖੇਡਾਂ ਨੇ ਉਹ ਸ਼ਹਿਰਾਂ ਦੀਆਂ ਖੇਡਾਂ ਤੋਂ ਵੱਖਰੀਆਂ ਨੇ ਅਤੇ ਪਿੰਡਾਂ ਦੀਆਂ ਖੇਡਾਂ ਨਾਲ ਆਪਸੀ ਭਾਈਚਾਰਾ ਵੀ ਬਣਿਆ ਰਹਿੰਦਾ ਹੈ